ਖਾਸ ਸੱਭਿਆਚਾਰਕ ਅਭਿਆਸ ਜੋ ਕਿ ਵਿਸ਼ੇਸ਼ ਤਰ੍ਹਾਂ ਦੇ ਪੂਜਾ ਕਰਨ 'ਤੇ ਅਪਣਾਉਂਦੇ ਹਾਂ ਜਿਵੇਂ ਕਿ ਵਰਤਾਂ ਦੇ ਦੌਰਾਨ ਦੋ ਚੁੰਨੀਆਂ ਜੋੜ ਕੇ ਪੂਜਾ ਕੀਤੀ ਜਾਂਦੀ ਹੈ ਜੋ ਕਿ ਇੱਕ ਸੁਹਾਗਣ ਦਾ ਸ਼ਿੰਗਾਰ ਮੰਨਿਆ ਜਾਂਦਾ ਹੈ ਅਤੇ ਇਸ ਤੋਂ ਬਾਅਦ ਜਦੋਂ ਵੀ ਕੋਈ ਘਰ ਵਿੱਚ ਨਵੀਂ ਚੀਜ਼ ਲਿਆਉਂਦੀ ਜਾਂਦੀ ਹੈ ਜਾਂ ਪੂਜਾ ਕਰਵਾਈ ਜਾਂਦੀ ਹੈ ਤਾਂ ਕੰਨਾਂ ਦੇ ਕੰਨਿਆਂ ਦੇਵੀਆਂ ਦੇ ਪੈਰ ਧੋਏ ਜਾਂਦੇ ਹਨ ਜੋ ਕਿ ਇੱਕ ਸੱਭਿਆਚਾਰਿਕ ਅਭਿਆਸ ਹੈ ਸੱਭਿਆਚਾਰਕ ਅਭਿਆਸ ਸਾਨੂੰ ਸੱਭਿਆਚਾਰ ਨਾਲ ਜੋੜ ਕੇ ਰੱਖਦੇ ਹਨ ਅਤੇ ਇਸਦਾ ਸਾਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਸਾਰੇ ਧਰਮਾਂ ਦੇ ਆਪਣੇ ਅਲੱਗ ਅਲੱਗ ਤਰ੍ਹਾਂ ਦੇ ਅਭਿਆਸ ਹਨ ਜੋ ਕਿ ਉਹ ਪੂਜਾ ਕਰਨ ਦੌਰਾਨ ਪਾਠ ਕਰਨ ਦੌਰਾਨ ਜਾਂ ਨਮਾਜ ਪੜ੍ਹਨ ਦੇ ਦੌਰਾਨ ਵਰਤਦੇ ਹਨ